ਮੌਜੂਦਾ ਘਟਨਾ ਮੈਂ ਪਿਛਲੇ ਸਾਲ ਦੀ ਗੱਲ ਕਰਾਂਗਾ ਜਦੋਂ ਪੰਜਾਬ ਦੀ ਨਵੀਂ ਸਰਕਾਰ ਆਈ ਆ ਮ ਭਗਵੰਤ ਮਾਨ ਜੀ ਦੀ ਇੱਕ ਬਹੁਤ ਬੜਾ ਚੇਂਜ ਲਿਆਂਦਾ ਆਮ ਜਨਤਾ ਨੇ ਉਸ ਚੇਂਜ ਨੇ ਜਿਹੜੀ ਸਾਨੂੰ ਚੀਜ਼ ਲਿਆ ਕੇ ਦਿੱਤੀ ਆ ਉਹ ਇਹ ਆ ਕਿ ਵੀ ਕੋਈ ਵੀ ਕਿਸੇ ਵੀ ਕੀਮਤ 'ਤੇ ਇਹ ਨਹੀਂ ਕਹਿ ਸਕਦਾ ਕਿ ਮੇਰਾ ਮਾਲਕਾਨਾ ਹੱਕ ਹੋ ਗਿਆ ਲਉ ਜੀ ਅਸੀਂ ਤਾਂ ਜਿੱਤਾਂਗੇ ਕਦੇ ਤੁਸੀ ਜਿੱਤ ਗਏ ਕਦੇ ਅਸੀਂ ਜਿੱਤ ਗਏ ਉਸ ਚੀਜ਼ ਤੋਂ ਬਾਹਰ ਕੱਢ ਲਿਆਂਦਾ ਸਾਰਿਆਂ ਸਾਰੇ ਕਾਸੇ ਨੂੰ ਜਿਸ ਤਰ੍ਹਾਂ ਸੈਂਟਰ ਗੋਵਰਨਮੈਂਟ ਕਾਂਗਰਸ ਤੋਂ ਬੜੀ ਦੇਰ ਬਾਅਦ ਸੈਟਿੰਗ ਹੋ ਕੇ ਬਾਹਰ ਨਿਕਲ ਕੇ ਬੀ ਜੇ ਪੀ ਦੇ ਕੋਲ ਗਈ ਹੈ ਤਾਂ ਉਸ ਤਰ੍ਹਾਂ ਪੰਜਾਬ ਦੇ ਵਿੱਚੋਂ ਦੋ ਪਾਰਟੀਆਂ ਨੂੰ ਜਿਹੜੀਆਂ ਰਵਾਇਤੀ ਪਾਰਟੀਆਂ ਚੱਲੀਆਂ ਆ ਰਹੀਆਂ ਤੀਆ ਕਦੀ ਉਹ ਕਦੀ ਉਹ ਹੁਣ ਉਨ੍ਹਾਂ ਤੋਂ ਬਾਅਦ ਇੱਕ ਨਵੀਂ ਪਾਰਟੀ ਆਈ ਅਤੇ ਉਹਦੇ ਵਿੱਚ ਇੱਕ ਬੜੀ ਚੀਜ਼ ਚੰਗੀ ਮਿਲੀ ਸਾਨੂੰ ਚੌਵੀ ਸਾਲ ਪੱਚੀ ਸਾਲ ਤੀਹ ਸਾਲ ਦੇ ਬੱਤੀ ਸਾਲ ਦੇ ਨੌਜਵਾਨ ਮੁੰਡੇ ਨਿਕਲ ਕੇ ਉੱਭਰ ਕੇ ਸਾਹਮਣੇ ਆਏ ਆ ਕਹਿਣ ਨੂੰ ਨਵੇਂ ਆ ਜੀ ਇਨ੍ਹਾਂ ਨੂੰ ਕਿਆ ਆਉਂਦਾ ਕੁਛ ਨਹੀਂ ਆਉਂਦਾ ਬਾਕੀ ਉਂਗਲੀ ਫੜ ਕੇ ਹੀ ਮਾਂ ਦੀ ਸਿੱਖਦਾ ਹੁੰਦਾ ਤੁਰਨਾ ਬੰਦਾ ਕਦੀ ਨਾ ਕਦੀ ਉਹ ਵੀ ਅੱਗੇ ਪਹੁੰਚਣਗੇ ਤਾਂ ਬੜੀ ਚੰਗੀ ਚੀਜ਼ ਹੋਈ ਆ ਪੰਜਾਬ ਵਾਸਤੇ ਇਹ ਜੇ ਇਸ ਤਰ੍ਹਾਂ ਦਾ ਬਦਲਾਉ ਆਇਆ ਹੈ ਤਾਂ ਉਹ ਅੱਗੇ ਜਾ ਕੇ ਸਾਨੂੰ ਕੋਈ ਫਾਇਦਾ ਕਰਕੇ ਦੇਵੇ ਕੋਈ ਜ਼ਰੂਰੀ ਨਹੀਂ ਹੁੰਦਾ ਕਿ ਤੁਸੀਂ ਰਵਾਇਤੀ ਪਾਰਟੀਆਂ ਨੂੰ ਹਰ ਵਾਰੀ ਬਦਲ ਬਦਲ ਕੇ ਵੋਟਾਂ ਪਾਉਂਦੇ ਰਹੋ ਤਾਂ ਅੱਗੇ ਚਲਦੇ ਰਹੀਏ ਮੈਨੂੰ ਇਹ ਚੀਜ਼ ਬੜੀ ਚੰਗੀ ਲੱਗੀ ਤੀ ਪੰਜਾਬ ਦੀ ਜੋ ਹੋਈ ਤੀ ਸ਼ਾਇਦ ਸਾਨੂੰ ਇਹ ਸਾਡੇ ਆਉਣ ਵਾਲੇ ਟਾਈਮ ਵਾਸਤੇ ਸਾਡੇ ਬੱਚਿਆਂ ਵਾਸਤੇ ਬਹੁਤ ਜ਼ਿਆਦਾ ਚੰਗਾ ਹੋ ਜਾਵੇ